ਹੈਲੋ ਭਾਅ ਜੀ ਮੇਰੀ ਕੇਸ਼ਵ ਦੇ ਢਾਬੇ ਤੋਂ ਗੱਲ ਹੋ ਰਹੀ ਏ ਹਾਂਜੀ ਹਾਂਜੀ ਮੈਂ ਨਾ ਸਿਮਰਨਜੀਤ ਕੌਰ ਬੋਲ ਰਹੀ ਹਾਂ ਮੈਂ ਨਾ ਲੁਧਿਆਣੇ ਤੋਂ ਆਈ ਹਾਂ ਮੈਂ ਤੁਹਾਡੇ ਢਾਬੇ ਬਾਰੇ ਸੁਣਿਆ ਸੀ ਤੁਹਾਡਾ ਢਾਬੇ ਦਾ ਰੈਸਟੋਰੈਂਟ ਜਿਵੇਂ ਤੁਹਾਡਾ ਢਾਬਾ ਬਹੁਤ ਹੀ ਜਿਵੇਂ ਵਧੀਆ ਹੈਗਾ ਇੱਥੋਂ ਦਾ ਖਾਣਾ ਸਭ ਕੁਝ ਜਿਵੇਂ ਇੱਥੋਂ ਦੀਆਂ ਜੋ ਵੀ ਸਨੈਕਸ ਵਗੈਰਾ ਜੋ ਸਭ ਬਹੁਤ ਵਧੀਆ ਹੈਗਾ ਅਤੇ ਮੇਰਾ ਨਾ ਬਰਡੇ ਪਾਰਟੀ ਹੈਗੀ ਹੈ ਮੈਂ ਸਪੈਸ਼ਲ ਆਪਣੇ ਫਰੈਂਡਸ ਨੂੰ ਇੱਥੇ ਦੇਣ ਆਈ ਹਾਂ ਅੰਮ੍ਰਿਤਸਰ ਵਿੱਚ ਬਰਡੇ ਪਾਰਟੀ ਦੇਣ ਆਈ ਹਾਂ ਉਹ ਕਹਿ ਰਹੇ ਸੀ ਕਿ ਆਪਾਂ ਕੇਸ਼ਵ ਦੇ ਢਾਬੇ ਵਿੱਚ ਹੀ ਬਰਡੇ ਪਾਰਟੀ ਕਰਨੀ ਹੈ ਕਿਉਂਕਿ ਇੱਥੋਂ ਦਾ ਖਾਣਾ ਬਹੁਤ ਜ਼ਿਆਦਾ ਵਧੀਆ ਹੈਗਾ ਵਾ ਇੱਥੇ ਟੇਬਲ ਵਗੈਰਾ ਦੀ ਵੀ ਸਹੂਲਤ ਬਹੁਤ ਵਧੀਆ ਹੈਗੀ ਹੈ ਕਹਿ ਰਹੇ ਦੱਸ ਰਹੇ ਸੀ ਮੇਰੇ ਨਾ ਸੌ ਕੁ ਫਰੈਂਡਸ ਹੈਗੇ ਆ ਅਤੇ ਸੌ ਕੁ ਫਰੈਂਡਸ ਦਾ ਤੁਹਾਡੇ ਕੋਲ ਟੇਬਲ ਦਾ ਬੰਦੋਬਸਤ ਪੂਰਾ ਹੋਏਗਾ ਖਾਣੇ ਦਾ ਵੀ ਹਾਂਜੀ ਅਤੇ ਤੁਸੀਂ ਨਾ ਉਹਨਾਂ ਦੀ ਬੁਕਿੰਗ ਜਾਂ ਪਹਿਲਾਂ ਕਰ ਦੋਗੇ ਕਿ ਬਾਅਦ ਵਿੱਚ ਜਿਵੇਂ ਜਦੋਂ ਆਪਾਂ ਆਵਾਂਗੇ ਉਦੋਂ ਹੀ ਕਰ ਲਉਗੇ ਜਾਂ ਤੁਹਾਨੂੰ ਐਡਵਾਂਸ ਕੋਈ ਪੇਮੈਂਟ ਦੇਣੀ ਹੈ ਜਾਂ ਪਹਿਲਾਂ ਕਿ ਨਹੀਂ ਦੇਣੀ ਇਹ ਤੁਸੀਂ ਮੈਨੂੰ ਕਨਫਰਮ ਦੱਸ ਦਿਉ ਅਤੇ ਨਾਲ਼ ਪਾਰਕਿੰਗ ਦਾ ਤੁਸੀਂ ਜ਼ਰੂਰ ਦੱਸਣਾ ਕਿ ਉੱਥੇ ਪਾਰਕਿੰਗ ਦਾ ਬੰਦੋਬਸਤ ਪੂਰਾ ਹੈਗਾ ਜਿਵੇਂ ਉਹਨਾਂ ਦੀਆਂ ਗੱਡੀਆਂ ਵਗੈਰਾ ਵੀ ਹੋਣਗੀਆਂ ਪੂਰੀਆਂ ਗੱਡੀਆਂ ਆਰਾਮ ਨਾਲ਼ ਲੱਗ ਸਕਦੀ ਹੈ ਕੋਈ ਦਿੱਕਤ ਵਗੈਰਾ ਤਾਂ ਨਹੀਂ ਹੈਗੀ ਤੁਸੀਂ ਆ ਪੂਰੀ ਤਰ੍ਹਾਂ ਮੈਨੂੰ ਦੱਸ ਦੇਣਾ ਅਤੇ ਬਸ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਖੁਸ਼ ਖੁਸ਼ ਕਰਕੇ ਭੇਜੋਗੇ ਕਿ ਇੰਨਾਂ ਵਧੀਆ ਖਾਣਾ ਖਵਾਓਗੇ ਉਹਨਾਂ ਨੂੰ ਵੀ ਖੁਸ਼ੀ ਹੋਏਗੀ ਕਿ ਆਪਾਂ ਕੇਸ਼ਵ ਦੇ ਢਾਬੇ 'ਤੇ ਆਏ ਹਾਂ ਖਾਣਾ ਖਾਧਾ ਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਸ ਇਹੀ ਤੁਹਾਡੇ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਨੂੰ ਬਹੁਤ ਵਧੀਆ ਖਾਣਾ ਖਵਾਓਗੇ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ